ਹਾਂਜੀ ਕਰਨਵੀਰ ਜੀ ਗੱਲ ਕਰਦੇ ਪਏ ਨੇ ਠੀਕ ਹੈ ਪਛਾਣਿਆ ਭਾਅ ਜੀ ਠੀਕ ਹੈ ਚਲੋ ਹੋਰ ਕੀ ਹਾਲ ਚਾਲ ਨੇ ਤੁਹਾਡੇ ਅੱਛਾ ਹੋਰ ਕਿੱਥੇ ਰਹਿੰਦੇ ਅੱਜ ਕੱਲ੍ਹ ਠੀਕ ਆ ਮਤਲਬ ਮੈਂ ਤੁਹਾਡੇ ਤੋਂ ਇਹ ਪੁੱਛਣ ਵਾਸਤੇ ਫ਼ੋਨ ਕੀਤਾ ਸੀ ਕਿ ਆਪਾਂ ਨਾ ਹੁਣ ਮਤਲਬ ਅੰਮ੍ਰਿਤਸਰ 'ਚ ਆਏ ਹਾਂ ਸਾਡੀ ਰਿਹਾਇਸ਼ ਹੈਗੀ ਆ ਹਾਲ ਗੇਟ ਦੇ ਲਾਗੇ ਛਾਗੇ ਅਤੇ ਮੈਂ ਨਾ ਹੁਣ ਮੈਨੂੰ ਦਿੱਕਤ ਇਹ ਆ ਰਹੀ ਆ ਮੈਨੂੰ ਬਾਕੀ ਸਾਰਾ ਸੈਟਲਮੈਂਟ ਸਾਡਾ ਹੋ ਗਿਆ ਸਾਨੂੰ ਦਿੱਕਤ ਇਹ ਆ ਰਹੀ ਕਿ ਮੈਂ ਆਪਣੇ ਨਾ ਮੁੰਡੇ ਨੂੰ ਅੰਸ਼ ਨੂੰ ਸਕੂਲ ਪਾਉਣਾ ਚਾਹੁੰਦਾ ਸੀ ਕਿਸੇ ਅਤੇ ਮੈਨੂੰ ਕੋਈ ਇੱਦਾਂ ਦੀ ਸਲਾਹ ਦੇਵੋ ਕਿਹੜਾ ਸਕੂਲ ਅੰਮ੍ਰਿਤਸਰ ਦੇ ਵਿੱਚ ਬੈਸਟ ਹੈਗਾ ਅਤੇ ਮਤਲਬ ਹਾਲ ਗੇਟ ਦੇ ਲਾਗੇ ਛਾਗੇ ਸਾਨੂੰ ਪੈ ਜੇ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਠੀਕ ਹੈ ਜੀ ਠੀਕ ਹੈ ਠੀਕ ਹੈ ਅੱਛਾ ਮਤਲਬ ਠੀਕ ਆ ਮਤਲਬ ਟੇਕ ਕੇਅਰ ਕਰਦੇ ਨਾ ਬੱਚੇ ਦੀ ਵੀ ਠੀਕ ਹੀ ਆ ਮਤਲਬ ਜ਼ਿਆਦਾ ਮਤਲਬ ਅੱਛਾ ਅੱਛਾ ਠੀਕ ਆ ਚਲੋ ਇਹੋ ਹੀ ਬੈਸਟ ਰਹੇਗਾ ਫਿਰ ਸਕੂਲ ਜਿਹੜਾ ਤੁਸੀਂ ਦੱਸਿਆ ਮਾਲ ਰੋਡ ਲਾਗੇ ਜਿਹੜਾ ਇਹੀ ਨਾ ਮਾਨ ਮਾਲ ਰੋਡ ਦੇ ਉੱਤੇ ਜਿਹੜਾ ਸਕੂਲ ਜੇ ਮੈਂ ਸਹੀ ਹੋਵਾਂ ਤਾਂ ਠੀਕ ਆ ਠੀਕ ਆ ਚਲੋ ਠੀਕ ਹੈ ਭਾਅ ਜੀ ਧੰਨਵਾਦ ਤੁਹਾਡੀ ਬਹੁਤ ਬਹੁਤ ਮਿਹਰਬਾਨੀ